ਜਿਵੇਂ ਕਿ ਸਾਡੇ ਬਰਨਾਲਾ ਬੀ ਆਰ ਸੀ ਮਾਲ ਵਿੱਚ ਇਕ ਸੰਗੀਤ ਉਤਸਵ ਹੋਣ ਜਾ ਰਿਹਾ ਹੈ ਮੈਂ ਇਸ ਸੰਗੀਤ ਉਤਸਵ ਵਿੱਚ ਸ਼ਾਮਲ ਹੋਣਾ ਚਾਹੁੰਦਾ ਹਾਂ ਮੈਨੂੰ ਗਾਉਣ ਦਾ ਵੀ ਬਹੁਤ ਸ਼ੌਂਕ ਹੈ ਇਸ ਕਰਕੇ ਮੈਂ ਇਸ ਸੰਗੀਤ ਉਤਸਵ ਵਿੱਚ ਭਾਗ ਲੈਣਾ ਚਾਹੁੰਦਾ ਹਾਂ ਮੈਂ ਇਹ ਪੁੱਛਣਾ ਹੈ ਕਿ ਸੰਗੀਤ ਉਤਸਵ ਦਾ ਸਮਾਂ ਕਿੰਨੇ ਤੋਂ ਕਿੰਨਾ ਅਤੇ ਟਿਕਟਾਂ ਅਸੀਂ ਆਨਲਾਈਨ ਕਿਵੇਂ ਲੈ ਸਕਦੇ ਹਾਂ ਟਿਕਟਾਂ ਦੀ ਕੀਮਤ ਕਿੰਨੀ ਹੋਵੇਗੀ ਮੈਨੂੰ ਸੰਗੀਤ ਉਤਸਵ ਵਿੱਚ ਸ਼ਾਮਲ ਹੋਣ ਦੀ ਬਹੁਤ ਦਿਲਚਸਪੀ ਹੈ ਮੈਨੂੰ ਗਾਉਣ ਦਾ ਬਹੁਤ ਸ਼ੌਂਕ ਹੈ ਜੋ ਵੀ ਇਸ ਸੰਗੀਤ ਉਤਸਵ ਵਿੱਚ ਫਸਟ ਪੁਜੀਸ਼ਨ 'ਤੇ ਆਵੇਗਾ ਉਸਨੂੰ ਬੜੀ ਧੂਮਧਾਮ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਇਸ ਸੰਗੀਤ ਉਤਸਵ ਵਿੱਚ ਭਾਗ ਲੈਣਾ ਚਾਹੀਦਾ ਹੈ ਮੈਨੂੰ ਗੁਰਦਾਸ ਮਾਨ ਗਾਇਕ ਦੇ ਗਾਣੇ ਬਹੁਤ ਪਸੰਦ ਹਨ ਮੈਂ ਸਵੇਰੇ ਹਰ ਰੋਜ਼ ਗਾਣੇ ਸੁਣਦਾ ਹਾਂ ਸੁਣਦਾ ਹਾਂ ਮੈਨੂੰ ਗਾਉਣ ਦਾ ਬਚਪਨ ਤੋਂ ਹੀ ਸ਼ੌਂਕ ਸੀ ਮੈਂ ਹਰ ਰੋਜ਼ ਸਵੇਰੇ ਸ਼ਾਮ ਗਾਣੇ ਬੜੀ ਦਿਲਚਸਪੀ ਨਾਲ ਸੁਣਦਾ ਹਾਂ ਸ਼ਾਮਲ ਹੋਣਾ ਚਾਹੁੰਦਾ ਹਾਂ ਮੈਨੂੰ ਗਾਉਣ ਦਾ ਵੀ ਬਹੁਤ ਸ਼ੌਂਕ ਹੈ ਇਸ ਕਰਕੇ ਮੈਂ ਇਸ ਸੰਗੀਤ ਉਤਸਵ ਵਿੱਚ ਭਾਗ ਲੈਣਾ ਚਾਹੁੰਦਾ ਹਾਂ ਟਿਕਟਾਂ ਦੀ ਕੀਮਤੀ ਕਿੰਨੀ ਹੋਵੇਗੀ ਮੈਨੂੰ ਸੰਗੀਤ ਉਤਸਵ ਵਿੱਚ ਸ਼ਾਮਲ ਹੋਣ ਦੀ ਬਹੁਤ ਦਿਲਚਸਪੀ ਹੈ ਇਸ ਸੰਗੀਤ ਉਤਸਵ ਵਿੱਚ ਫਸਟ ਪੁਜੀਸ਼ਨ 'ਤੇ ਆਵੇਗਾ ਉਸਨੂੰ ਬੜੀ ਧੂਮ ਧਾਮ ਨਾਲ ਸਨਮਾਨਿਤ ਕੀਤਾ ਜਾਵੇਗਾ ਸਾਨੂੰ ਸਾਰਿਆਂ ਨੂੰ ਸੰਗੀਤ ਉਤਸਵ ਵਿੱਚ ਭਾਗ ਲੈਣਾ ਚਾਹੀਦਾ